ਮੈਂ ਮਨੀਸ਼ਾ ਕੁਮਾਰੀ ਪਿੰਡ ਢੌਂਸਾ ਤੋਂ ਬੋਲ ਰਹੀ ਹਾਂ ਜਿਵੇਂ ਕਿ ਮੈਂ ਅੱਜ ਤੁਹਾਡੇ ਸਿਲਵਰ ਰੋਕ ਹੋਟਲ ਤੋਂ ਅੱਜ ਖਾਣਾ ਔਰਡਰ ਕੀਤਾ ਸੀ ਹੈ ਨਾ ਜਿਸ ਵਿੱਚ ਮਟਰ ਪਨੀਰ ਚਾ ਮਟ ਕੜੀ ਚਾਲ ਚਾਵਲਸ ਹੈ ਨਾ ਇਹ ਸਭ ਸੀਗਾ ਅਤੇ ਮੇਰੇ ਕੱਲ ਗੈਸ਼ਟ ਆਏ ਵੇ ਸੀਗੇ ਤਾਂ ਮੈਂ ਤੁਹਾਡੇ ਸੋਚਿਆ ਵੀ ਤੁਹਾਡੇ ਔਰਡਰ ਮਤਲਬ ਤੁਹਾਡੇ ਔਰ ਤੁਹਾਨੂੰ ਔਰਡਰ ਕਰਦਾਂ ਨਾ ਤੁਹਾਡੇ ਹੋਟਲ ਤੋਂ ਹੈ ਨਾ ਅਤੇ ਕੀਤਾ ਤੋ ਜਦੇ ਮੈਂ ਪੈਕਜ ਖੋਲ੍ਹ ਲਿਆ ਹੈ ਨਾ ਅਤੇ ਦੇਖਿਆ ਕਿ ਓ ਜਿਹੜੇ ਦੇ ਉਹ ਆ ਨਾ ਦਾਲ ਉਹ ਦਾਲ ਮਤਲਬ ਬਾਸੀ ਜਿਹੀ ਹੈ ਮਤਲਬ ਸਮੈਲ ਆ ਰਹੀ ਸੀ ਇੱਕ ਤਰ੍ਹਾਂ ਤੋਂ ਖਰਾਬ ਹੈ ਲੱਗ ਰਹੀ ਸੀ ਹੈ ਨਾ ਅਤੇ ਜਬ ਜੇ ਉਹਤੋਂ ਬਾਅਦ ਮੈਂ ਸਬਜ਼ੀ ਦੇਖੀ ਸਬਜ਼ੀ ਤਾਂ ਠੀਕ ਹੋਊਗੀ ਹੈ ਨਾ ਜਦ ਸਬਜ਼ੀ ਦੇਖੀ ਉਹ ਵੀ ਵਿੱਚ ਇੰਨਾ ਤੇਲ ਅਤੇ ਤੇਲ ਛੱਡੋ ਤੇਲ ਤਾਂ ਹੈਗਾ ਹੀ ਹੈਗਾ ਮਸਾਲਾ ਇੰਨਾ ਪਾਇਆ ਸੀ ਨਾ ਦੱਬ ਕੇ ਮਤਲਬ ਬੰਦਾ ਕਹੇ ਕਿ ਹਾਂ ਕਿ ਬੰਦਾ ਕੀ ਖਾਵੇ ਇਸ ਬੰਦੇ ਨੂੰ ਬਮਾ ਦੇਖ ਕੇ ਹੀ ਬੰਦਾ ਬਿਮਾਰ ਹੋ ਜਾਵੇ ਤੋ ਮੈਨੂੰ ਜਵਾਂ ਵੀ ਪਸੰਦ ਨਹੀਂ ਆਈ ਹੈ ਨਾ ਅਤੇ ਮੇਰੇ ਜਿਹੜੇ ਗੈਸਟ ਆਏ ਸੀ ਉਹ ਤਾਂ ਇੰਨਾ ਡਿਜਰਵ ਖਾ ਵੀ ਨਹੀਂ ਸਕਦੇ ਮਤਲਬ ਕਿ ਖਾਣਾ ਇੱਦਾਂ ਦਾ ਹੈ ਨਾ ਮਸਾਲੇ ਦਾ ਤੇਲ ਕੋਈ ਬੰ ਬਿਮਾਰੀ ਦਾ ਘਰ ਇੱਕ ਤਰ੍ਹਾਂ ਦੇਖਿਆ ਜਾਏ ਤਾ ਮਸਾਲੇ ਦਾ ਅਤੇ ਮੈਨੂੰ ਜਮਾਂ ਪਸੰਦ ਨਹੀਂ ਅਤੇ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਮੈਨੇਜਰ ਤੁਹਾਨੂੰ ਬੇਨਤੀ ਕਿ ਤੁਸੀਂ ਆਪਣੇ ਡਿਲੀਵਰੀ ਵਾਲੇ ਨੂੰ ਭੇਜ ਕੇ ਨਾ ਮੇਰੇ ਨਾ ਜਿਹੜਾ ਖਾਣਾ ਹੈ ਦਿੱਤਾ ਤੁਸੀਂ ਇਹ ਵਾਪਸ ਕਰੋ ਅਤੇ ਅੱਗੋਂ ਤੋਂ ਤੁਸੀਂ ਥੋਨੂੰ ਕੋਈ ਔਰਡਰ ਵੀ ਕਰਦਾ ਤੁਸੀਂ ਖਾਣਾ ਚੈੱਕ ਕਰਕੇ ਦੇਖ ਕੇ ਫਿਰ ਦਿਆ ਕਰੋ ਠੀਕ ਹੈ ਓਕੇ ਧੰਨਵਾਦ ਜੀ